ਅੰਮ੍ਰਿਤਸਰ ਵਿੱਚ ਸਿਹਤ ਸੰਭਾਲ ਪ੍ਰਣਾਲੀ ਕਾਫੀ ਅੱਛੀ ਹੈ ਬਹੁਤ ਮਾਮਲਿਆਂ 'ਚ ਅੱਛੀ ਹੈ ਅਤੇ ਜਿਵੇਂ ਕਿ ਇੱਥੇ ਸਾਡਾ ਅਮਨਦੀਪ ਹਸਪਤਾਲ ਹੈ ਹੱਡੀਆਂ ਦਾ ਡੋਕਟਰ ਹੈ ਹਸਪਤਾਲ ਹੈਗਾ ਇੱਥੇ ਬਹੁਤ ਹੀ ਦੂਰੋਂ ਦੂਰੋਂ ਵੀ ਮਰੀਜ਼ ਇਲਾਜ ਕਰਾਉਣ ਆਉਂਦੇ ਨੇ ਆਪਣੇ ਹੱਡੀਆਂ ਦਾ ਬਹੁਤ ਹੀ ਕੋਈ ਮਸ਼ਹੂਰ ਡੋਕਟਰ ਹੈ ਬਹੁਤ ਹੀ ਕੋਈ ਮਸ਼ਹੂਰ ਹੋਸਪਿਟਲ ਹੈ ਅਮਨਦੀਪ ਹੋਸਪਿਟਲ ਮੇਰੀ ਇੱਕ ਸਹੇਲੀ ਸੀਗੀ ਜਿਹੜੀ ਜਿਹਦੇ ਕਿ ਭਰਾ ਦੀ ਲੱਤ ਟੁੱਟ ਗਈ ਸੀਗੀ ਅਤੇ ਉਹ ਲੋਕ ਜੰਮੂ ਤੋਂ ਇੱਥੋਂ ਆਉਂਦੇ ਸੀਗੇ ਅੰਮ੍ਰਿਤਸਰ ਇਲਾਜ ਕਰਾਉਣ ਅਤੇ ਇੱਥੋਂ ਪਤਾ ਚੱਲਦਾ ਹੈ ਕਿ ਅਮ ਅਮਨਦੀਪ ਹਸਪਤਾਲ ਦਾ ਕਿਸ ਤਰ੍ਹਾਂ ਦੀ ਪ੍ਰਣਾਲੀ ਹੈ ਕਿਸ ਤਰ੍ਹਾਂ ਦੇ ਡੋਕਟਰਸ ਨੇ ਉੱਥੇ ਕੰਮ ਕਰ ਰਹੇ ਨੇ ਅਤੇ ਕਿਸ ਤਰ੍ਹਾਂ ਦੀ ਸੇਵਾਵਾਂ ਉਪਲਬਧ ਹਨ ਅਤੇ ਸਾਡੇ ਇੱਥੋਂ ਦੇ ਲੋਕ ਬਹੁਤ ਹੀ ਹੈਲਪਫੁੱਲ ਨੇ ਇਸ ਮਾਮਲੇ 'ਚ ਜਦੋਂ ਜੇ ਜੇਕਰ ਕੋਈ ਮੈਂ ਜੇ ਤੁਹਾਨੂੰ ਦੱਸਾਂ ਇੱਥੋਂ ਦੇ ਹੋਸਪੀਟਲ ਜਿਵੇਂ ਕਿ ਆਪਣਾ ਨਿਊਰੋ ਆਪਣਾ ਪ੍ਰਭਜੀਤ ਹੈ ਡੋਕਟਰ ਸਾਡੇ ਬਹੁਤ ਸਾਰੇ ਇੱਥੇ ਡੋਕਟਰਸ ਨੇ ਜਿਹੜੇ ਬਹੁਤ ਹੀ ਕਾਬਿਲ ਨੇ ਜਿਨ੍ਹਾਂ ਨੇ ਕਿ ਅੰਮ੍ਰਿਤਸਰ ਦੀ ਸਿਹਤ ਪ੍ਰਣਾਲੀ ਨੂੰ ਆਪਣੇ ਕੰਧਿਆਂ 'ਤੇ ਚੁੱਕਿਆ ਹੋਇਆ ਅਤੇ ਮੈਂ ਇਹੀ ਸਮਝਦੀ ਹਾਂ ਕਿ ਜਦੋਂ ਵੀ ਕਦੀ ਸਾਨੂੰ ਕੋਈ ਲੋੜ ਪਈ ਹੈ ਤਾਂ ਸਾਨੂੰ ਅੰਮ੍ਰਿਤਸਰ ਤੋਂ ਬਾਹਰ ਨਹੀਂ ਜਾਣਾ ਪਿਆ ਇਹ ਸਾਡੇ ਡੋਕਟਰਾਂ ਦੀ ਹੀ ਮਿਹਰਬਾਨੀ ਹੈ ਔਰ ਉਹਨਾਂ ਨੇ ਬਹੁਤ ਚੰਗਾ ਇਹ ਸ਼ਹਿਰ ਨੂੰ ਸੰਭਾਲਿਆ ਹੋਇਆ ਹੈ ਮੈਂ ਇਹੀ ਸਮਝਦੀ ਹਾਂ